ਮੈਂ ਸਭ ਤੋਂ ਪਹਿਲਾਂ ਆਪਣੇ ਨਾ ਫਰਿਜ ਦੇ ਲਈ ਇੱਕ ਸਟੈਂਡ ਮੰਗਵਾਇਆ ਸੀ ਉਹਦੇ ਉੱਪਰ ਫਰਿਜ ਰੱਖ ਕੇ ਆਪਾਂ ਫਰਿਜ ਨੂੰ ਇੱਕ ਜਗ੍ਹਾ ਦੂਜੀ ਜਗ੍ਹਾ 'ਤੇ ਲੈ ਕੇ ਵੀ ਜਾ ਸਕਦੇ ਹਾਂ ਅਤੇ ਨੀਚੇ ਤੋਂ ਉਹਦੇ ਪੋਚਾ ਲਗਾਉਣਾ ਵੀ ਸੌਖਾ ਹੁੰਦਾ ਮੈਂ ਉਹ ਦੇਖਿਆ ਸਾਈਡ 'ਤੇ ਮੈਂ ਫਿਰ ਮੰਗਵਾਇਆ ਮੈਨੂੰ ਉਹ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਮੈਂ ਮੈਨੂੰ ਪਹਿਲਾਂ ਇਹ ਸੁਣਨ 'ਚ ਮਿਲਿਆ ਸੀ ਕਿ ਅਸੀਂ ਜਿਹੜਾ ਮੰਗਵਾਉਂਦੇ ਹਾਂ ਇੱਦਾਂ ਕੋਈ ਚੀਜ਼ ਵੀ ਪਰੋਡਕਟ ਲੈਂਦੇ ਹਾਂ ਅਸੀਂ ਉਹ ਵਧੀਆ ਨਹੀਂ ਆਉਂਦੀਆਂ ਪਰ ਜਦੋਂ ਮੈਂ ਉਹਨੂੰ ਦੇਖਿਆ ਸੀ ਉਹ ਬਹੁਤ ਹੀ ਅੱਛਾ ਆਇਆ ਜਿਵੇਂ ਦਾ ਮੈਂ ਸੋਚਿਆ ਸੀ ਉਵੇਂ ਦਾ ਹੀ ਹੈ ਉਹਨੂੰ ਮੈਂ ਫਿਕਸ ਕਰ ਸਕਦੀ ਹਾਂ ਮੈਂ ਵੱਡੀ ਫਰਿਜ ਦੇ ਨੀਚੇ ਵੀ ਲਗਾ ਸਕਦੇ ਉਹਨੇ ਛੋਟੀ ਫਰਿਜ ਦੇ ਨੀਚੇ ਵੀ ਲਗਾ ਸਕਦੀ ਹਾਂ ਕਿਉਂਕਿ ਉਹ ਈਜ਼ੀਲੀ ਛੋਟਾ ਜਿਹਾ ਵੱਡਾ ਹੋਣ ਵਾਲਾ ਹੈਗਾ ਜਿਹੜੀ ਸਾਈਡ ਨੂੰ ਵੀ ਉਹਨੂੰ ਮੈਂ ਚਾਹਾਂ ਉਸ ਸਾਈਡ ਮੈਂ ਉਹਨੂੰ ਵਧਾ ਜਾਂ ਘਟਾ ਸਕਦੀ ਹਾਂ ਅਤੇ ਉਹ ਜਿਹੜਾ ਹੈ ਉਹਨੂੰ ਮੈਂ ਅਗਰ ਫਰਿਜ ਨਹੀਂ ਤਾਂ ਉਹਨੂੰ ਮੈਂ ਆਪਣੀ ਵਾਸ਼ਿੰਗ ਮਸ਼ੀਨ ਦੇ ਨੀਚੇ ਵੀ ਯੂਜ਼ ਕੀਤਾ ਸੀ ਉੱਥੇ ਵੀ ਉਹ ਵਧੀਆ ਤਰੀਕੇ ਨਾਲ ਫਿੱਟ ਹੋ ਗਿਆ ਮੈਨੂੰ ਉਹ ਦੇਖ ਕੇ ਨਾ ਬਹੁਤ ਹੀ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਕਿਉਂਕਿ ਉਹ ਬਿਲਕੁਲ ਹੀ ਸਹੀ ਚੀਜ਼ ਜਿਹੜੀ ਸੀ ਉਹ ਮੈਨੂੰ ਮਿਲ ਗਈ